ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੰਗੜਾ ਪੰਜਾਬੀ ਨੌਜਵਾਨਾਂ ਦਾ ਮੁੱਖ ਨਾਚ ਹੈ ਲਗਭਗ ਹਰ ਖੁਸ਼ੀ ਦੇ ਮੁੱਖ ਦੇ ਭੰਗੜਾ ਪਾਇਆ ਜਾਂਦਾ ਹੈ ਜਿਹਨਾਂ ਵਿੱਚੋਂ ਵਿਸਾਖੀ ਦਾ ਮੇਲਾ ਪ੍ਰਮੁੱਖ ਹੈ ਜਦੋਂ ਕਿਸਾਨ ਆਪਣੀ ਫ਼ਸਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤਾਂ ਉਹ ਭੰਗੜਾ ਪਾਉਂਦੇ ਹਨ ਭੰਗੜਾ ਤਾਕਤ ਹਿੰਮਤ ਬਹਾਦਰੀ ਅਤੇ ਜੋਸ਼ ਨਾਲ ਭਰਪੂਰ ਨਾਚ ਹੈ ਅਤੇ ਭੰਗੜੇ ਵਿੱਚ ਢੋਲ ਢੋਲ ਅ ਢੋਲ ਦਾ ਨਾਚ ਦਾ ਮੁੱਖ ਸਾਂਝ ਹੈ ਅਤੇ ਢੋਲੀ ਭੰਗੜਾ ਪੇਸ਼ ਕਰਨ ਵਾਲੇ ਨੌਜਵਾਨਾਂ ਵਿਕ ਵਿਚਕਾਰ ਖੜ੍ਹਾ ਹੁੰਦਾ ਹੈ ਜਦੋਂ ਢੋਲ ਵੱਜਦਾ ਹੈ ਤਾਂ ਨੌਜਵਾਨ ਨੱਚਣ ਲੱਗ ਪੈ ਲੱਗ ਜਾਂਦੇ ਹਨ ਜਿਵੇਂ ਅ ਜਿਵੇਂ ਜਿਵੇਂ ਢੋਲ ਦੀ ਤਾਲ ਬਦਲਦੀ ਬਦਲਦੀ ਹੈ ਨੱਚਣ ਵਾਲੇ ਨੌਜਵਾਨਾਂ ਦੀਆਂ ਹਰਕਤਾਂ ਬਦਲਦੀਆਂ ਹਨ ਢੋਲ ਦੀ ਬੀਟ ਨਾਲ ਸ ਸਰੀਰ ਦੀਆਂ ਸਾਰੀਆਂ ਹਰਕਤਾਂ ਚੱਲਦੀਆਂ ਹਨ ਤਾਲ ਹੌਲੀ ਹੌਲੀ ਵਧਦੀ ਜਾਂਦੀ ਹੈ ਜਿਸ ਜਿਸ ਨਾਲ ਸਰੀਰ ਦੀਆਂ ਹਰਕਤਾਂ ਵੀ ਦੇ ਤੇਜ਼ ਹੁੰਦੀਆਂ ਹਨ ਅੱਜ ਕੱਲ੍ਹ ਭੰਗੜੇ ਨੇ ਵੱਖ ਵੱਖ ਨਾਚਾਂ ਦੀਆਂ ਮੁਦਰਾਵਾਂ ਨੂੰ ਅਪਣਾਇਆ ਹੈ ਜਿਸਦੇ ਜਿਸ ਨੇ ਇਸ ਦੇ ਸਟੇਜ ਸਟੇਜ ਸਰੂਪ ਨੂੰ ਜਨਮ ਦਿੱਤਾ ਹੈ